ਅਸੀਂ ਰਸੋਈ ਵਿੱਚ ਚੂਹੇ ਕਾਕਰੋਚ ਤੋਂ ਜ਼ਿਆਦਾਤਰ ਆਟਾ ਕਣਕ ਚੀਨੀ ਵਰਗੀਆਂ ਦੀਆਂ ਬੋਰੀਆਂ ਬਚਾਉਂਦੇ ਹਾਂ ਕਿਉਂਕਿ ਇਹ ਇਹਨਾਂ ਦੇ ਵਿੱਚ ਜਾ ਕੇ ਬੋਰੀਆਂ ਨੂੰ ਕੁਤਰਦੇ ਹਨ ਅਤੇ ਅਨਾਜ ਅਤੇ ਚੀਨੀ ਨੂੰ ਖ਼ਰਾਬ ਕਰਦੇ ਹਨ ਅਤੇ ਬਾਅਦ ਦੇ ਵਿੱਚ ਇਹ ਵਰਤਣ ਦੇ ਲਾਇਕ ਨਹੀਂ ਰਹਿੰਦੀ ਕੋਕਰੋਚ ਦੇ ਵੜਨ ਨਾਲ ਉਸ 'ਤੇ ਉਸਦੇ ਉਪਯੋਗ ਖਾਣੇ ਦੇ ਉਪਯੋਗ ਕਰਨ ਨਾਲ ਸਾਨੂੰ ਫੂਡ ਪੋਈਜ਼ਿੰਨਗ ਵਰਗੀਆਂ ਬਿਮਾਰੀਆਂ ਵੀ ਹੁੰਦੀਆਂ ਹਨ